ਹਾਂ ਮੈਂ ਸਿਲਾਈ ਜਾਣਦੀ ਹਾਂ ਮੈਂ ਔਰਤਾਂ ਦੇ ਹਰ ਤਰ੍ਹਾਂ ਦੇ ਕੱਪੜੇ ਸੀ ਸਕਦੀ ਹਾਂ ਸਲਵਾਰਾਂ ਜਿਵੇਂ ਅਲੱਗ ਅਲੱਗ ਤਰ੍ਹਾਂ ਦੀਆਂ ਅਫਗਾਨੀ ਸਲਵਾਰ ਪਲਾਜੋ ਇਸ ਤਰਾਂ ਦੇ ਕੱਪੜੇ ਸੀ ਸਕਦੀ ਆ ਬੱਚਿਆਂ ਦੇ ਫਰਾਕਾ ਸੀ ਸਕਦੀ ਆ ਆਦਮੀਆਂ ਦੀਆਂ ਸ਼ਰਟਾਂ ਸੀ ਸਕਦੀ ਆ ਬੱਚਿਆਂ ਦੇ ਪੰਜਾਮੇ ਨਿੱਕਰਾਂ ਘਰ ਦੇ ਕਈ ਛੋਟੇ ਮੋਟੇ ਜਿਵੇਂ ਸਿਰਾਣਿਆਂ ਦੇ ਕਵਰ ਵੱਖ ਵੱਖ ਤਰਾਂ ਦੇ ਡਿਜਾਈਨਰ ਕੂਸ਼ਨ ਕਵਰ ਬੱਚਿਆਂ ਦੇ ਨਿੱਕਰ ਵਗੈਰਾ ਤੇ ਇਹ ਸਾਡੇ ਇਲਾਕੇ ਵਿੱਚ ਕਈ ਮਰਦ ਵੀ ਇਹ ਕੰਮ ਕਰਦੇ ਹਨ ਮੇਰੇ ਚਾਚਾ ਜੀ ਆਪ ਦਰਜੀ ਹਨ ਮੈਂ ਪਲਾਜੋ ਦੀ ਕਟਾਈ ਉਹਨਾਂ ਤੋਂ ਸਿੱਖੀ ਫਿਰ ਅੱਜ ਕੱਲ ਚੱਲਦੇ ਨਵੇਂ ਰਿਵਾਜ ਜਿਵੇਂ ਕੀ ਕੋਈ ਅਫਗਾਨੀ ਸਲਵਾਰ ਕੋਈ ਪਾਕਿਸਤਾਨੀ ਸਲਵਾਰ ਇਹਨਾਂ ਬਾਰੇ ਮੈਂ ਥੋੜਾ ਜਿਹਾ ਉਹਨਾਂ ਤੋਂ ਪੁੱਛਿਆ ਇੱਕ ਹੋਰ ਸਾਡੇ ਘਰ ਦੇ ਲਾਗੇ ਇਕ ਦਰਜੀ ਹ ਮੈਂ ਕਈ ਚੀਜ਼ਾਂ ਉਹਨਾਂ ਤੋਂ ਪੁੱਛਿਆ ਕਿਉਂਕਿ ਪਹਿਲਾਂ ਤੋਂ ਇਲਾਵਾ ਹੁਣ ਦੇ ਵਿੱਚ ਕਈ ਚੀਜ਼ਾਂ ਦਾ ਅੰਤਰ ਆਇਆ ਹੈ ਕੁਛ ਨਈਂ ਕਟਿੰਗ ਦੇ ਡਿਜਾਇਨ ਹਨ ਤੇ ਇਹਨਾਂ ਦੀ ਜਾਣਕਾਰੀ ਮੈਂ ਆਪਣੇ ਘਰ ਦੇ ਕੋਲ ਇੱਕ ਦਰਜ਼ੀ ਸੀ ਉਹਦੇ ਤੋਂ ਸਿੱਖੀ ਕਿਉਂਕਿ ਜਦ ਮੈਂ ਐ ਸਿਲਾਈ ਸਿੱਖੀ ਸੀ ਉਦੋਂ ਸਲਵਾਰਾਂ ਚੱਲਦੀਆਂ ਸਨ ਪਰ ਅੱਜ ਕੱਲ ਜਿਵੇਂ ਪਲਾਜ਼ੋ ਚੱਲਦੇ ਹਨ ਗਰਾਰੇ ਚੱਲਦੇ ਹਨ ਸ਼ਰਾਰੇ ਚਲਦੇ ਹਨ ਇਹਨਾਂ ਦੀ ਜਾਣਕਾਰੀ ਮੈਂ ਆਪਣੇ ਘਰ ਦੇ ਕੋਲ ਇੱਕ ਦਰਜੀ ਸੀ ਉਸ ਤੋਂ ਸਿੱਖੀ ਫਿਰ ਮੇਰੇ ਚਾਚਾ ਜੀ ਦਰਜੀ ਹਨ ਮੈਂ ਕਈਆਂ ਗੱਲਾਂ ਉਹਨਾਂ ਤੋਂ ਸਿੱਖੀਆ ਮੇਰੇ ਮਾਮਾ ਜੀ ਵੀ ਦਰਜੀ ਆ ਮੈਂ ਆਉਣਾ ਤਾਂ ਪੁੱਛਿਆ ਫਿਰ ਇੱਕ ਹੋਰ ਦਰਜੀ ਆ ਉਸਨੇ ਮੈਨੂੰ ਪਲਾਜੋ ਦੀ ਕਟਾਈ ਕਰਨੀ ਦੱਸੀ ਅਫਗਾਨੀ ਸਲਵਾਰ ਦੱਸੀ ਤਾਂ ਹੋਰ ਕਈ ਨਈਂ ਤਕਨੀਕਾਂ ਬਾਰੇ ਮੈਨੂੰ ਜਾਣਕਾਰੀ ਦਿੱਤੀ